ਹੈਲੋ ਸਰ ਤੁਸੀਂ ਮਿੰਤਰਾ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹੋ ਜੀ ਸਰ ਮੈਂ ਲਾਸਟ ਵੀਕ ਇੱਥੋਂ ਲੈਕਮੀ ਦੀ ਸਨਸਕਰੀਨ ਓਡਰ ਕੀਤੀ ਸੀਗੀ ਮੇਰਾ ਓਡਰ ਨੰਬਰ ਹੈਗਾ ਟੂ ਫਾਈਵ ਸਿਕਸ ਸੈਵਨ ਜੀ ਸਰ ਇਹ ਨਾ ਮੇਰੀ ਇੱਕ ਫਰੈਂਡ ਨੇ ਰੀਕੋਮੈਂਡ ਕੀਤੀ ਸੀਗੀ ਕਿ ਜਿਹੜੀ ਲੈਕਮੀ ਦੀ ਸਨਸਕ੍ਰੀਨ ਹੈ ਇਹ ਬਹੁਤ ਵਧੀਆ ਹੈ ਤਾਂ ਮੈਂ ਵੀ ਓੱਥੋਂ ਦੇਖ ਕੇ ਮਿੰਤਰਾ 'ਤੇ ਓਡਰ ਪਾਤੀ ਬੱਟ ਹੁਣ ਮੈਂ ਇਹ ਹੀ ਦੱਸਣਾ ਚਾਹੁੰਦੀ ਹਾਂ ਕਿ ਪਹਿਲਾਂ ਜਦੋਂ ਮੈਂ ਉਹਦੀ ਪੈਕਿੰਗ ਖੋਲ੍ਹੀ ਤਾਂ ਉਹਦੀ ਪੈਕਿੰਗ ਹੀ ਬਹੁਤ ਬੇਕਾਰ ਸੀਗੀ ਪਹਿਲਾਂ ਤਾਂ ਔਰ ਨੰਬਰ ਦੋ ਜਦੋਂ ਮੈਂ ਉਹਨੂੰ ਓਪਨ ਕੀਤਾ ਉਹਦੀ ਜਿਹੜੀ ਬੋਟਲ ਸੀਗੀ ਉਹ ਨਾ ਲੀਕੇਜ ਹੋ ਰਹੀ ਸੀਗੀ ਅਤੇ ਮੈਂ ਪੰਜ ਸੌ ਰੁਪਏ ਦੀ ਓਡਰ ਕੀਤੀ ਸੀਗੀ ਅਤੇ ਉਹ ਬਹੁਤ ਹੀ ਛੋਟੀ ਜਿਹੀ ਬੋਟਲ ਸੀਗੀ ਬੱਟ ਫਿਰ ਵੀ ਮੈਨੂੰ ਲੱਗਿਆ ਕਿ ਚੱਲੋ ਕੋਈ ਗੱਲ ਨਹੀਂ ਓਸ ਤੋਂ ਬਾਅਦ ਮੈਂ ਉਹਦੀ ਸੀਲ ਖੋਲ੍ਹੀ ਓਪਨ ਕੀਤਾ ਔਰ ਮੈਂ ਜਦੋਂ ਉਹਨੂੰ ਯੂਜ ਕਰਕੇ ਦੇਖਿਆ ਪਹਿਲਾਂ ਤਾਂ ਕੀ ਆ ਕਿ ਮੇਰੀ ਲਗਾਉਣ ਨਾਲ ਸਕਿਨ ਡੈਮੇਜ ਹੋ ਗਈ ਰਾਈਟ ਮਤਲਬ ਮੈਂ ਯੂਜ ਕੀਤੀ ਲਗਉਂਦੇ ਬਾਅਦ ਹੀ ਪੰਜ ਮਿੰਟ ਬਾਅਦ ਹੀ ਮੈਨੂੰ ਬਹੁਤ ਜ਼ਿਆਦਾ ਜਲਣ ਹੋਣ ਲੱਗ ਗਈ ਔਰ ਦੈਨ ਮੈਂ ਉਹਨੂੰ ਪਾਣੀ ਨਾਲ ਵੋਸ਼ ਕਰ ਲਿਆ ਰਾਈਟ ਪਾਣੀ ਨਾਲ ਵੋਸ਼ ਕਰਨ ਤੋਂ ਬਾਅਦ ਵੀ ਤੁਸੀਂ ਦੇਖੋ ਕਿ ਮੇਰੇ ਬਹੁਤ ਜ਼ਿਆਦਾ ਰੈਸ਼ਸ ਹੋ ਗਏ ਰੈਡ ਰੈਡ ਹੋ ਗਏ ਠੀਕ ਹੈ ਅਤੇ ਮੈਂ ਹੁਣ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਮੈਂ ਪਹਿਲਾਂ ਤਾਂ ਇਸ ਪ੍ਰੋਡਕਟ ਦੀ ਬਿਲਕੁਲ ਜ਼ੀਰੋ ਰੇਟਿੰਗ ਦਊਂਗੀ ਕਿਉਂਕਿ ਮੈਨੂੰ ਬਿਲਕੁਲ ਵੀ ਸੂਟ ਨਹੀਂ ਕੀਤੀ ਹੈ ਅਤੇ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਕਿਰਪਾ ਕਰਕੇ ਜਿੰਨੀ ਵੀ ਮੈਂ ਇਹਦੀ ਮਨੀ ਲਗਾਈ ਹੈ ਤੁਸੀਂ ਮੈਨੂੰ ਉਹ ਵਾਪਿਸ ਕਰ ਦਿਓ ਠੀਕ ਹੈ ਸਰ ਬਸ ਠੀਕ ਹੈ ਠੀਕ ਹੈ ਸਰ ਠੀਕ ਹੈ